ਹਾਂਜੀ ਮੈਂ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਵਿੱਚ ਪਾਸ ਕੀਤੀ ਹੋਈ ਹੈ ਹੁਣ ਮੈਂ ਖੰਨਾ ਪੇਪਰ ਮਿੱਲ ਦੇ ਵਿੱਚ ਜੋਬ ਕਰ ਰਿਹਾ ਮੈਂ ਨਾਲ ਦੀ ਨਾਲ ਆਪਣੇ ਭਵਿੱਖ ਦੇ ਵਿੱਚ ਚਾਹੁੰਦਾ ਹਾਂ ਕਿ ਮੈਂ ਰੇਲਵੇ ਦੇ ਵਿੱਚ ਐਜ ਏ ਇੰਜੀਨੀਅਰਿੰਗ ਭਰਤੀ ਹੋਵਾਂ ਉਸ ਵਾਸਤੇ ਮੈਂ ਇਹ ਜੋ ਖੰਨਾ ਪੇਪਰ ਮਿੱਲ ਦੇ ਵਿੱਚ ਜੋਬ ਕਰਦਾ ਹੋਇਆ ਨਾਲ ਦੀ ਨਾਲ ਮੈਂ ਰੇਲਵੇ ਦੀ ਜੋਬ ਵਾਸਤੇ ਟੈਸਟਾਂ ਦੀ ਤਿਆਰੀ ਕਰ ਰਿਹਾ ਤਾਂ ਜੋ ਮੈਂ ਰੇਲਵੇ ਦੇ ਵਿੱਚ ਐਜ ਏ ਜੂਨੀਅਰ ਇੰਜੀਨੀਅਰ ਭਰਤੀ ਹੋਵਾਂ ਅਤੇ ਜੂਨੀਅਰ ਇੰਜੀਨੀਅਰ ਭਰਤੀ ਹੋ ਕੇ ਅੱਗੇ ਦੀ ਅੱਗੇ ਆਪਣੀ ਪੋਸਟ ਦੇ ਵਿੱਚ ਵੱਧਦਾ ਜਾਵਾਂ ਜਿਵੇਂ ਸੀਨੀਅਰ ਇੰਜੀਨੀਅਰ ਬਣਾਂਗਾ ਸੀਨੀਅਰ ਇੰਜੀਨੀਅਰ ਬਣਦਾ ਹੋਇਆ ਮੈਂ ਰੇਲਵੇ ਦੇ ਵਿੱਚ ਐਜ ਏ ਡਾਇਰੈਕਟਰ ਪਦ 'ਤੇ ਪਹੁੰਚਾਂਗਾ ਅਤੇ ਰੇਲਵੇ ਦਾ ਸਾਰਾ ਕਾਰਜ ਭਾਰ ਦੇਖਾਂਗਾ ਅਤੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਏਗੀ ਜਦੋਂ ਮੈਂ ਹੋਰਨਾਂ ਵਰਕਰਾਂ ਤੋਂ ਵਧੀਆ ਤਰੀਕੇ ਦੇ ਨਾਲ ਰੇਲਵੇ ਦੇ ਵਿੱਚ ਕੰਮ ਕਰ ਲਵਾਂਗਾ ਇਹ ਮੈਂ ਭਵਿੱਖ ਦੇ ਵਿੱਚ ਇਹ ਪਹੁੰਚਣਾ ਚਾਹੁੰਦਾ ਹਾਂ ਕਿ ਮੈਂ ਰੇਲਵੇ ਦੇ ਉੱਚ ਅਹੁਦੇ 'ਤੇ ਪਹੁੰਚਾ